ਵੋਕਲ ਦੀ ਥਕਾਵਟ ਤਾਂ ਜ਼ਿਆਦਾਤਰ ਰਿਆਜ਼ ਨਾਲ ਦੂਰ ਹੁੰਦੀ ਹੈ ਜਦੋਂ ਰਿਆਜ਼ ਕਰਦੇ ਹਾਂ ਅਤੇ ਉਹ ਉਹਦੇ 'ਚ ਆਪਣੇ ਆਪ ਠਹਿਰਾਓ ਅਤੇ ਆਪਣੇ ਆਪ ਤੁਹਾਡੇ 'ਚ ਸਟੈਮੀਨਰ ਆ ਜਿਹੜਾ ਉਹ ਆਪ ਹੀ ਵੱਧਦਾ ਏ ਅਤੇ ਬਾਕੀ ਇਹਦੀਆਂ ਜੇ ਮਤਲਬ ਇਹਨੂੰ ਸੁਰੱਖਿਆ ਰੱਖਣ ਲਈ ਕਿਹੜੀਆਂ ਤਕਨੀਕਾਂ ਨੇ ਤਾਂ ਮੰਨ ਲਓ ਮਲੱਠੀ ਖਾ ਲਈ ਜਿਵੇਂ ਅਤੇ ਆਪਣਾ ਮਿਸ਼ਰੀ ਖਾ ਲਈ ਅਤੇ ਹੋਰ ਵੀ ਜਿੰਨੀਆਂ ਆਪਣੇ ਆਯੁਰਵੇਦਿਕ ਆਉਂਦੀਆਂ ਨੇ ਕਈ ਦਵਾਈਆਂ ਕਈ ਤਾਂ ਦਵਾਈਆਂ ਵੀ ਲੈਂਦੇ ਨੇ ਅਤੇ ਉਹਦੇ ਨਾਲ ਵੀ ਆਪਣਾ ਗਰਮ ਪਾਣੀ ਪੀਣਾ ਹਮੇਸ਼ਾਂ ਅਤੇ ਜ਼ਿਆਦਾ ਠੰਡਾ ਪਾਣੀ ਨਹੀਂ ਪੀਣਾ ਠੰਡੀਆਂ ਚੀਜ਼ਾਂ ਨਹੀਂ ਖਾਣੀਆਂ ਅਤੇ ਬਾਕੀ ਰਿਆਜ਼ ਨਾਲ ਸਾਰਿਆਂ ਨਾਲੋਂ ਵਧੀਆ ਏ ਰਿਆਜ਼ ਜਿੰਨਾਂ ਚਿਰ ਜਿੰਨਾਂ ਗੂੜਾ ਰਿਆਜ਼ ਹੁੰਦਾ ਉਨੀ ਓ ਤੁਹਾਡੀ ਆਵਾਜ਼ ਆਪਣੀ ਸੁਰੱਖਿਅਤ ਰਹਿੰਦੀ ਆ ਅਤੇ ਉਹਦੇ 'ਚ ਕੋਈ ਕੋਈ ਉਹ ਨਹੀਂ ਹੁੰਦਾ ਹੈ ਪਰ ਕੋਈ ਪ੍ਰੋਬਲਮ ਨਹੀਂ ਆਉਂਦੀ ਅਤੇ ਮੈਂ ਤਾਂ ਬਸ ਇਹ ਨੀ ਥੋੜ੍ਹੀ ਚੀਜ਼ਾਂ ਕਰਦਾ ਇਹੀ ਚੀਜ਼ਾਂ ਕਰਦਾ ਇਸ ਤੋਂ ਜ਼ਿਆਦਾ ਨਹੀਂ